ਮੇਰਾ ਮੰਨਣਾ ਹੈ ਕਿ ਮੌਜੂਦਾ ਰੁਝਾਨਾਂ ਨਾਲ ਜੁੜੇ ਰਹਿਣ ਲਈ ਅਤੇ ਉਹਨਾਂ ਰੁਝਾਨਾਂ ਦੀਆਂ ਯਾਦਾਂ ਨੂੰ ਆਪਣੇ ਨਾਲ ਹਮੇਸ਼ਾਂ ਸੰਭਾਲ ਕੇ ਰੱਖਣ ਦੇ ਲਈ ਫੋਟੋਗ੍ਰਾ ਗ੍ਰਾਫ਼ੀ ਜੋ ਹੈ ਬੜੀ ਹੀ ਜ਼ਰੂਰੀ ਹੈ ਤਾਂ ਮੈਂ ਜਿਵੇਂ ਕਿ ਕੋਈ ਪੁਸਤਕ ਮੇਲਾ ਹੁੰਦਾ ਹੈ ਫਰੀਦਕੋਟ ਪੁਸਤਕ ਮੇਲਾ ਹੋਇਆ ਜਾਂ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਪੁਸਤਕ ਮੇਲਾ ਹੋਇਆ ਤਾਂ ਮੈਂ ਉੱਥੇ ਗਈ ਸਾਂ ਅਤੇ ਉੱਥੇ ਮੈਂ ਕਈ ਸਾਰੀ ਫੋਟੋਗ੍ਰਾਫ਼ੀ ਕੀਤੀ ਇਸ ਤੋਂ ਇਲਾਵਾ ਜੇਕਰ ਕੋਈ ਵੀ ਟੂਰਿਸਟ ਪਲੇਸ ਹੈ ਕਿਤੇ ਵੀ ਮੇਰਾ ਜਾਣਾ ਆਉਣਾ ਹੁੰਦਾ ਹੈ ਤਾਂ ਮੈਂ ਉੱਥੇ ਵੀ ਫੋਟੋਗ੍ਰਾਫ਼ੀ ਕਰਦੀ ਹਾਂ ਜਿਵੇਂ ਅੰਮ੍ਰਿਤਸਰ ਸਾਹਿਬ ਮੈਂ ਥੋੜ੍ਹੀ ਬਹੁਤ ਫੋਟੋਗ੍ਰਾਫ਼ੀ ਕੀਤੀ ਹੋਈ ਹੈ ਇਸ ਤੋਂ ਇਲਾਵਾ ਜਿਵੇਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉੱਥੇ ਵੀ ਮੈਂ ਫੋਟੋਗ੍ਰਾਫ਼ੀ ਜਾ ਕੇ ਕਰਦੀ ਹਾਂ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉੱਥੇ ਵੀ ਫੋਟੋਗ੍ਰਾਫ਼ੀ ਕੀਤੀ ਹੈ ਇਸ ਤੋਂ ਇਲਾਵਾ ਵਿਸਾਖੀ ਦਾ ਮੇਲਾ ਜੋ ਕਿ ਦਮਦਮਾ ਸਾਹਿਬ ਤਲਵੰਡੀ ਸਾਬੋ ਹੁਣੇ ਹੀ ਲੱਗ ਕੇ ਹਟਿਆ ਹੈ ਤਾਂ ਉੱਥੇ ਵੀ ਮੈਂ ਫੋਟੋਗ੍ਰਾਫ਼ੀ ਕੀਤੀ ਸੀ ਫੋਟੋਗ੍ਰਾਫ਼ੀ ਕਰਨਾ ਮੇਰਾ ਇੱਕ ਸ਼ੌਂਕ ਹੈ ਮੇਰੇ ਮਨ ਨੂੰ ਫੋਟੋਗ੍ਰਾਫ਼ੀ ਕਰਨਾ ਚੰਗਾ ਲੱਗਦਾ ਹੈ